ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਸੁਖਮਨੀ ਹਾਂ ਅਤੇ ਮੈਂ ਰੀਸੈਂਟਲੀ ਕੈਨੇਡਾ ਤੋਂ ਤਰਨਤਾਰਨ ਸ਼ਿਫਟ ਹੋਈ ਸੀ ਅਤੇ ਮੇਰੇ ਕੁਝ ਰੈਲੇਟਿਵਸ ਵੀ ਮੇਰੇ ਨਾਲ਼ ਨੇ ਅਤੇ ਮੈਨੂੰ ਤੁਸੀਂ ਕੁਝ ਟਰਾਂਸਪੋਰਟੇਸ਼ਨ ਬਾਰੇ ਦੱਸੋਗੇ

ਹਾਂਜੀ ਓਕੇ ਸਰ ਸਰ ਜਿਵੇਂ ਅਸੀਂ ਕਈ ਵਾਰ ਦੂਰ ਜਾਣਾ ਹੁੰਦਾ ਅਤੇ ਉਹਦੇ ਲਈ ਆਪਾਂ ਕਿਹੜਾ ਟਰਾਂਸਪੋਟੇਸ਼ਨ ਯੂਜ ਕਰ ਸਕਦੇ ਹਾਂ ਹਾਂਜੀ ਅਤੇ ਕੈਬ ਵਗੈਰਾ ਦਾ ਕੋਈ ਸਿਸਟਮ ਹੈਗਾ ਓਕੇ ਸਰ ਨਹੀਂ ਸਰ ਬਸ ਥੈਂਕ ਯੂ